ਪਹਿਲਾਂ ਪਿਆਰ ਭਰੀ ਆ ਸਤਿ ਸ਼੍ਰੀ ਅਕਾਲ ਜੀ ਜੇਕਰ ਅੱਜ ਆਪਾਂ ਗੱਲ ਕਰੀਏ ਹੁਣ ਅਤੇ ਪੁਰਾਣੇ ਸਮੇਂ ਦੀ ਅੱਜ ਅਤੇ ਪੁਰਾਣੇ ਸਮੇਂ 'ਚ ਬਹੁਤ ਹੀ ਫਰਕ ਹੈ ਅੱਜ ਕੱਲ੍ਹ ਜਿਹੜਾ ਸਮਾਂ ਹੈ ਬਹੁਤ ਹੀ ਤੇਜ਼ ਚੱਲਦਾ ਹੈ ਕਿ ਅੱਜ ਦੇ ਸਮੇਂ 'ਚ ਬਹੁਤ ਹੀ ਟੈਕਨੀਕ ਵਰਤੀ ਜਾਂਦੀ ਹੈ ਜੋ ਕਿ ਪੁਰਾਣੇ ਸਮਿਆਂ ਵਿੱਚ ਨਹੀਂ ਸੀ ਜੋ ਜੇਕਰ ਆਪਾਂ ਗੱਲ ਕਰੀਏ ਤਾਂ ਪੜ੍ਹਾਈ ਦੀ ਜੇ ਪੁਰਾਣੇ ਸਮਿਆਂ ਵਿੱਚ ਪੜ੍ਹਾਈ ਬਹੁਤ ਹੀ ਘੱਟ ਹੁੰਦੀ ਸੀ ਅਤੇ ਜ਼ਿਆਦਾਤਰ ਨਿਆਣੇ ਪੜ੍ਹਾਈ ਵੱਲ ਨੂੰ ਬਹੁਤ ਪੜ੍ਹਾਈ ਵੱਲ ਨੂੰ ਘੱਟ ਘੱਟ ਸੀ ਅਤੇ ਜ਼ਿਆਦਾ ਕ ਵੱਲ ਖੇਡਾਂ ਵੱਲ ਹੁੰਦੇ ਸੀ ਪਰ ਜੇ ਅੱਜ ਕੱਲ੍ਹ ਦੀ ਗੱਲ ਕਰੀਏ ਤਾਂ ਤਾਂ ਲੋਕ ਜ਼ਿਆਦਾਤਰ ਪੜ੍ਹਾਈ ਨੂੰ ਪ੍ਰੈ ਪ੍ਰੈਫੇਰੇਂਸ ਦਿੰਦੇ ਹਨ ਜੋ ਕਿ ਅ ਉਹਨਾਂ ਲਈ ਬਹੁਤ ਹੀ ਵਧੀਆ ਗੱਲ ਹੈ ਕਿਉਂਕਿ ਅੱਜ ਕੱਲ੍ਹ ਦੇ ਸਮੇਂ ਵਿੱਚ ਪੜ੍ਹਾਈ ਤੋਂ ਇਲਾਵਾ ਕੋਈ ਸੀ ਵਰਗ ਦੇ ਵਿੱਚ ਨੌਕਰੀ ਮਿਲਣਾ ਬਹੁਤ ਹੀ ਔਖਾ ਹੈ ਜੇਕਰ ਆਪਾਂ ਗੱਲ ਕਰੀਏ ਪੁਰਾਣੇ ਸਮੇਂ ਵਿੱਚ ਟੈਕਨੋਲਜੀ ਬਹੁਤ ਹੀ ਘੱਟ ਹੁੰਦੀ ਸੀ ਅਤੇ ਅ ਘੱਟ ਹੁੰਦੀ ਸੀ ਜਿਸ ਦਾ ਬਹੁਤ ਹੀ ਵੱਡਾ ਨੁਕਸਾਨ ਰਿਹਾ ਹੈ ਜੇ ਕਿ ਜਿਵੇਂ ਕਿ ਪਹਿਲਾਂ ਲੋਕ ਯਾਤਰ ਕਿਤੇ ਵੀ ਜਾਂਦੇ ਸੀ ਉਹਨਾਂ ਨੂੰ ਬਹੁਤ ਹੀ ਸਮਾਂ ਲੱਗਦਾ ਸੀ ਜਾਣ ਲਈ ਪਰ ਜੇ ਜੇਕਰ ਅੱਜ ਦੀ ਗੱਲ ਕਰੀਏ ਤਾਂ ਟੈਕਨੀਕ ਦੇ ਐਨਾ ਫਰਕ ਆ ਗਿਆ ਹੈ ਕਿ ਲੋਕ ਕਿਤੇ ਵੀ ਜਾਂਦੇ ਹਾਂ ਅਤੇ ਬਹੁਤ ਹੀ ਘੱਟ ਸੈ ਸਮਾਂ ਲੱਗਦਾ ਹੈ ਅਤੇ ਇੰਨੇ ਵਹੀਕਲ ਹਨ ਕਿ ਜਿਵੇਂ ਕਿ ਮੋਟਰਸਾਈਕਲ ਕਾਰਾਂ ਟਰੇਨਾਂ ਜੋ ਕਿ ਅੱ ਪਹਿਲਾਂ ਦੇ ਸਮੇਂ ਨਾਲੋਂ ਵੱਧ ਗਈਆਂ ਹਨ ਅਤੇ ਇਹਨਾਂ ਦਾ ਸਾਡੇ ਲਈ ਬਹੁਤ ਹੀ ਸੌਖਾ ਬਹੁਤ ਹੀ ਆਸਾਨ ਹੈ ਕਿਉਂਕਿ ਅਸੀਂ ਅੱਜ ਅਤੇ ਕੱਲ੍ਹ ਕਿਤੇ ਵੀ ਪੜ੍ਹਨ ਜਾ ਸਕਦੇ ਹਨ ਅਤੇ ਸਾਨੂੰ ਦੇਸ਼ ਦੇ ਵਿੱਚ ਬਹੁਤ ਹੀ ਜ਼ਿਆਦਾ ਅੰਤਰ ਹਨ ਅਤੇ ਸਾਡੇ ਪੁਰਾਣੇ ਸਮੇਂ ਵਿੱਚ ਲੋਕਾਂ ਨੂੰ ਜੇਕਰ ਕੋਈ ਲੋਕ ਪੜ੍ਹਦਾ ਸੀ ਉਸਦੇ ਲਈ ਉਹਦੇ ਕੋਲ ਜਾਣ ਦੇ ਲਈ ਬਹੁਤ ਸਾਧਨ ਹੁੰਦਾ ਸੀ ਸਾਧਨ ਨਹੀਂ ਹੁੰਦਾ ਸੀ ਇਸਦੇ ਲਈ ਘਰਦਿਆਂ ਨੂੰ ਵੀ ਬਹੁਤ ਔਖੀ ਸੀ ਪਰ ਜੇਕਰ ਹੁਣ ਗੱਲ ਕਰੀਏ ਤਾਂ ਇਸ ਦੀ ਟੈਕਨੀਕ ਨਾਲ ਔਨਲਾਈਨ ਲੋਕ ਅੱਜ ਕੱਲ੍ਹ ਘਰ ਬੈਠੇ ਵੀ ਪੜ੍ਹ ਸਕਦੇ ਹਨ